ਮੈਂ ਉੱਤਰੀ ਭਾਰਤੀ ਭੋਜਨ ਦੇ ਵਿੱਚ ਬਟਰ ਚਿਕਨ ਬਣਾਉਣਾ ਪਸੰਦ ਕਰਾਂਗਾ ਕਿਉਂਕਿ ਇਸਦੇ ਜੋ ਫਲੇਵਰ ਹਨ ਉਹ ਸਾਰੇ ਦੇ ਸਾਰੇ ਇਸਦੇ ਮਸਾਲਿਆਂ ਤੋਂ ਆਉਂਦੇ ਹਨ ਅਤੇ ਜਿੰਨਾ ਪੰਜਾਬੀ ਖਾਣਾ ਹੈ ਉਹ ਵਧੀਆ ਮਸਾਲਿਆਂ ਦੇ ਵਿੱਚ ਬਣਦਾ ਹੈ ਉਹ ਹੋਰ ਕਿਤੇ ਵੀ ਨਹੀਂ ਮੈਂ ਸਾਊਥ ਇੰਡੀਆ ਵੀ ਘੁੰਮ ਕੇ ਵੇਖ ਲਿਆ ਮੈਂ ਮਿਡਲ ਵਾਲਾ ਇੰਡੀਆ ਵੀ ਘੁੰਮ ਕੇ ਦੇਖ ਲਿਆ ਈਸਟ ਵਾਲਾ ਵੀ ਘੁੰਮ ਕੇ ਦੇਖ ਲਿਆ ਪਰ ਇਸ ਦੇ ਨਾਲ ਦਾ ਖਾਣਾ ਕਿਤੇ ਵੀ ਨਹੀਂ ਮਿਲਦਾ ਅਤੇ ਜੇ ਮੈਂ ਕਿਸੇ ਨੂੰ ਖੁਸ਼ ਕਰਨਾ ਹੋਵੇ ਖਾਣਾ ਬਣਾ ਕੇ ਤਾਂ ਮੈਂ ਬਟਰ ਚਿਕਨ ਬਣਾ ਕੇ ਉਹਨੂੰ ਖੁਸ਼ ਕਰਨਾ ਪਸੰਦ ਕਰਾਂਗਾ